ਮੈਂ ਪੰਜਾਬ ਦਾ ਰਹਿਣ ਵਾਲਾ ਹਾਂ ਮੇਰਾ ਮੈਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੌਕ ਸੀ ਅਤੇ ਮੈਂ ਆਪਣੇ ਉਸਤਾਦ ਰੋਬਿਨ ਸਿੰਘ ਜੀ ਕੋਲੋਂ ਗਾਇਕੀ ਸਿੱਖਦੇ ਮੈਨੂੰ ਛੇ ਸਾਲ ਹੋ ਗਿਆ ਹੈ ਅਤੇ ਮੈਂ ਜਦੋਂ ਵੀ ਮੈਨੂੰ ਪੜ੍ਹਾਈ ਤੋਂ ਟਾਈਮ ਲੱਗਦਾ ਹੈ ਪੜ੍ਹਨ ਤੋਂ ਇਲਾਵਾ ਮੈਂ ਗਾਉਣ ਦੀ ਗਾਉਣ ਦਾ ਅਭਿਆਸ ਕਰਦਾ ਹਾਂ ਇਸ ਤੋਂ ਇਲਾਵਾ ਮੈਂ ਖੱਟੀਆਂ ਚੀਜ਼ਾਂ ਜਾਂ ਫਿਰ ਗਰਮ ਖੱਟੀਆਂ ਅਤੇ ਠੰਢੀਆਂ ਚੀਜ਼ਾਂ ਅਤੇ ਮਸਾਲੇਦਾਰ ਚੀਜ਼ਾਂ ਤੋਂ ਪਰਹੇਜ਼ ਹੀ ਕਰਦਾ ਹਾਂ ਅਤੇ ਮੈਂ ਜਦੋਂ ਵੀ ਮੇਰਾ ਮੈਨੂੰ ਲੱਗਦਾ ਹੈ ਕਿ ਮੇਰਾ ਗਲਾ ਖਰਾਬ ਹੋ ਰਿਹਾ ਹੈ ਤਾਂ ਮੈਂ ਗਰਮ ਪਾਣੀ ਪੀ ਕੇ ਗਰਾਰੇ ਕਰਦਾ ਹਾਂ ਮੈਂ ਬਾਹਰ ਦੀਆਂ ਮਸਾਲੇਦਾਰ ਚੀਜ਼ਾਂ ਨਹੀਂ ਖਾਂਦਾ ਕਿਉਂਕਿ ਉਸ ਨਾਲ ਗਲਾ ਖਰਾਬ ਹੁੰਦਾ ਹੈ ਅਤੇ ਮੈਂ ਦੋ ਤਿੰਨ ਕੰਪੀਟੀਸ਼ਨਾਂ ਵਿੱਚ ਵੀ ਗਿਆ ਹਾਂ ਹਾਲੇ ਤੱਕ ਚਲੋ ਮੈਂ ਮੈਨੂੰ ਸਲੈਕਟ ਨਹੀਂ ਹੋਇਆ ਪਰ ਫਿਰ ਵੀ ਮੈਂ ਕੋਸ਼ਿਸ਼ ਕਰਦਾ ਰਹਿੰਦਾ ਹਾਂ ਅਤੇ ਮੈਂ ਸਾਰਿਆਂ ਨੂੰ ਇਹੀ ਕਹਿੰਦਾ ਹਾਂ ਗਾਉਣ ਨਾਲ ਇੱਕ ਤਾਂ ਸਾਹ ਸਾਹ ਦੀ ਕੋਈ ਬਿਮਾਰੀ ਨਹੀਂ ਲੱਗਦੀ ਕਿਉਂਕਿ ਜਦੋਂ ਅਸੀਂ ਰਿਆਜ਼ ਕਰਦੇ ਹਾਂ ਜਾਂ ਅਭਿਆਸ ਕਰਦੇ ਹਾਂ ਤਾਂ ਸਾਨੂੰ ਸੁਰਾਂ ਦੇ ਮੁਤਾਬਕ ਚੱਲਣਾ ਪੈਂਦਾ ਹੈ ਜਿਸ ਨਾਲ ਸਾਡਾ ਸਾਹ ਉੱਪਰ ਥੱਲੇ ਹੁੰਦਾ ਹੈ ਜਿਸ ਕਰਕੇ ਮੇਰੀ ਸਰੀਰ ਦੀ ਸਰੀਰ ਦਾ ਮੇਰਾ ਠੀਕ ਰਹਿੰਦਾ ਹੈ ਸਰੀਰ ਵੀ ਠੀਕ ਰਹਿੰਦਾ ਹੈ ਅਤੇ ਜਿਸ ਨਾਲ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਮੈਂ ਸਾਰਿਆਂ ਨੂੰ ਕਹਾਂਗਾ ਕਿ ਗਾਉਣ ਵੱਲ ਧਿਆਨ ਦਿਓ